ਤੇਰਾਂ ਅਗਸਤ ਉੱਨੀ ਸੌ ਬੱਨਵੇਂ ਤੇਰਾਂ ਅਪ੍ਰੈਲ ਉੱਨੀ ਸੌ ਬੱਨਵੇਂ ਬਾਰਾਂ ਫਰਵਰੀ ਉੱਨੀ ਸੌ ਸਤਵੰਜਾ ਸੱਤ ਜੁਲਾਏ ਦੋ ਹਜ਼ਾਰ ਇੱਕੀ ਅਤੇ ਤੇਰਾਂ ਫਰਵਰੀ ਉੱਨੀ ਸੌ ਇਕੱਨਵੇਂ